ਖੇਤਾਂ ਵਿੱਚ ਜੇਕਰ ਕੰਮ ਕਰਦੇ ਆਪਾਂ ਕਹੀਏ ਕਿ ਲੋਕ ਗੀਤ ਆ ਜਿਹੜੇ ਉਹ ਗਾਏ ਜਾਂਦੇ ਹੈ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਲੋਕ ਆ ਜਿਹੜੇ ਉਹ ਟੋਲੀਆਂ ਦੇ ਵਿੱਚ ਕੰਮ ਕਰਦੇ ਸੀ ਉਦੋਂ ਇਕ ਜਾਂ ਦੋ ਬੰਦੇ ਗੀਤ ਗਾਉਂਦੇ ਸੀ ਤਾਂ ਜਿਹਦੇ ਨਾਲ ਦੂਸਰਿਆਂ ਦਾ ਵੀ ਮਨੋਰੰਜਨ ਹੁੰਦਾ ਰਹਿੰਦਾ ਸੀ ਅਤੇ ਨਾਲ ਹੀ ਉਸ ਸਮੇਂ ਜਿਹੜਾ ਲੋਕ ਸਖਤ ਮਿਹਨਤ ਕਰਦੇ ਸੀ ਤਾਂ ਰੇਡੀਓ ਦਾ ਵੀ ਉਪਯੋਗ ਕੀਤਾ ਜਾਂਦਾ ਸੀ ਰੇਡੀਓ 'ਤੇ ਜਿਹੜੇ ਗੀਤ ਸੁਣੇ ਜਾਂਦੇ ਸੀ ਪਰ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਜਿਹੜਾ ਹੁਣ ਹੈ ਉਹ ਸਮਾਂ ਜਿਹੜਾ ਵਿਗਿਆਨ ਦਾ ਯੁੱਗ ਆ ਗਿਆ ਜਿਸ ਨਾਲ ਜਿਹੜਾ ਖੇਤੀ ਕਰਨ ਦੇ ਸਾਧਨ ਅਤੇ ਤਰੀਕੇ ਵੀ ਬਦਲ ਚੁੱਕੇ ਹੈ ਇਸ ਦੇ ਨਾਲ ਹੀ ਜਿਹੜੇ ਮਨੋਰੰਜਨ ਦੇ ਸਾਧਨ ਹੈ ਉਹ ਵੀ ਬਦਲੇ ਹੈ ਹੁਣ ਲੋਕਾਂ ਦੇ ਟਰੈਕਟਰਾਂ ਉੱਪਰ ਵੱਡੇ ਵੱਡੇ ਜਿਹੜੇ ਡੈੱਕ ਲੱਗੇ ਹੋਏ ਆ ਇਹ ਡੈੱਕ ਹੁਣ ਜਿਹੜੇ ਮਨੋਰੰਜਨ ਦਾ ਸਾਧਨ ਨੇ ਹਰ ਮਨੁੱਖ ਜਿਹੜਾ ਉਹ ਆਪ ਨਹੀਂ ਗਾਉਂਦਾ ਉਹ ਜਿਹੜੇ ਅੱਜ ਦੇ ਸਮੇਂ ਦੇ ਹਿੱਪ ਹੋਫ ਗੀਤ ਹੈ ਉਹ ਗਾਏ ਜਾਂਦੇ ਹੈ ਇਹਨਾਂ ਗੀਤਾਂ ਰਾਹੀਂ ਜਿਹੜਾ ਮਨੋਰੰਜਨ ਕੀਤਾ ਜਾਂਦਾ ਇਸ ਨਾਲ ਇਕੱਲਾਪਣ ਵੀ ਆਇਆ ਲੋਕ ਗੀਤਾਂ ਦੀ ਜਿਹੜੀ ਪ੍ਰਬਲਤਾ ਉਹ ਘਟੀ ਆ ਹਾਂ ਜੇ ਉਹ ਪੁਰਾਣੇ ਲੋਕ ਗੀਤ ਰਿਕੋਰਡ ਹੋਏ ਹੋਏ ਆ ਉਹ ਜ਼ਰੂਰ ਸੁਣੇ ਜਾਂਦੇ ਆ ਪਰ ਜ਼ਿਕਰ ਕਰੀਏ ਕਿ ਜਿਹੜੇ ਨਵੇਂ ਲੋਕ ਗੀਤ ਕੁਛ ਆ ਰਹੇ ਆ ਉਹਨਾਂ ਦੀ ਜਿਹੜੀ ਇਹ ਵਰਤੋਂ ਨਹੀਂ ਹੋ ਰਹੀ